ਸਤਿ ਸ਼੍ਰੀ ਅਕਾਲ ਜੀ ਇਹ ਸਤਿਗੁਰੂ ਟਰੈਵਲ ਏਜੰਸੀ ਤੋਂ ਬੋਲ ਰਹੇ ਹੋ ਜੀ ਮੈਂ ਨਾ ਇੱਥੋਂ ਗੁੜਗਾਵਾਂ ਤੋਂ ਆਉਣਾ ਸੀਗਾ ਅੰਮ੍ਰਿਤਸਰ ਤੁਸੀਂ ਦੱਸ ਸਕਦੇ ਹੋ ਇੱਥੇ ਕਿਹੜੀਆਂ ਕਿਹੜੀਆਂ ਵੇਖਣ ਯੋਗ ਥਾਵਾਂ ਨੇ ਮੈਂ ਸੁਣਿਆ ਤਾਂ ਬਹੁਤ ਸੀ ਪਰ ਕਦੇ ਦੇਖਿਆ ਨਹੀਂ ਸੋਚਿਆ ਇਸ ਵਾਰ ਦੇਖ ਹੀ ਆਈਏ ਇੱਥੇ ਵੇਖਣ ਯੋਗ ਕੀ ਥਾਵਾਂ ਜੇ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਅਤੇ ਉੱਥੋਂ ਗੁੜਗਾਵਾਂ ਤੋਂ ਤੁਸੀਂ ਇਹ ਤੁਹਾਡੀ ਹੈਗੀ ਹੈ ਟਰਾਂਸਪੋਰਟ ਗੁੜਗਾਵਾਂ ਤੋਂ ਅੰਮ੍ਰਿਤਸਰ ਕੋਈ ਡਾਇਰੈਕਟ ਸਾਨੂੰ ਉੱਥੋਂ ਇੱਥੇ ਲੈ ਆਵੇ ਅਤੇ ਇੱਥੇ ਸਾਰਾ ਘੁੰਮਾ ਵੀ ਦੇ ਟੈਕਸ ਹਾਂਜੀ ਹਾਂਜੀ ਉਹ ਸਾਨੂੰ ਫੈਮਲੀ ਲਈ ਚਾਹੀਦੀ ਹੈ ਅਤੇ ਪਰ ਹੈਡ ਕੋਸਟ ਆ ਜਾਂ ਤੁਹਾਡਾ ਟੈਕਸੀ ਦਾ ਫੇਅਰ ਆ ਕੀ ਕਿਸ ਤਰ੍ਹਾਂ ਤੁਹਾਡਾ ਹਾਂਜੀ ਛੇ ਹਜ਼ਾਰ ਲੱਗੇਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅਤੇ ਸਾਡੀ ਨਾ ਤੁਸੀਂ ਇੱਦਾਂ ਕਰੋ ਬਾਈ ਜਨਵਰੀ ਦੀ ਫਿਰ ਬੁਕਿੰਗ ਕਰ ਲਓ ਬਾਈ ਜਨਵਰੀ ਸਾਨੂੰ ਨੌ ਵਜੇ ਉੱਥੋਂ ਗੁੜਗਾਵਾਂ ਤੋਂ ਲੈ ਲਿਓ ਅਤੇ ਕਿੰਨੇ ਵਜੇ ਇੱਥੇ ਅੰਮ੍ਰਿਤਸਰ ਪਹੁੰਚਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਅਤੇ ਫਿਰ ਉਹ ਰਹਿਣ ਵਗੈਰਾ ਦਾ ਵੀ ਤੁਸੀਂ ਇੰਤਜ਼ਾਮ ਕਰ ਦੋਂਗੇ ਸਾਰਾ ਠੀਕ ਹੈ ਜੀ ਇੱਥੇ ਤਿੰਨ ਚਾਰ ਦਿਨ ਦਾ ਸਾਡਾ ਟਰਿੱਪ ਹੋਏਗਾ ਠੀਕ ਹੈ ਜੀ ਧੰਨਵਾਦ ਜੀ ਓਕੇ